ਅੱਜ ਕੱਲ ਸੌਲਾਂ ਤੋਂ ਸਤਾਰਾਂ ਘੰਟੇ ਬਿਜਲੀ ਘਰ ਰਹਿੰਦੀ ਆ ਜਿਹਦੇ ਨਾਲ ਕਿ ਲਾਈਫ ਅੱਛੀ ਚਲਦੀ ਐ ਸਮੂਥ ਚੱਲ ਰਹੀ ਐ ਠੀਕ ਐ ਪਰ ਕਈ ਵਾਰੀ ਮੌਸਮ ਖਰਾਬ ਕਰਕੇ ਜਿਵੇਂ ਜਿਆਦਾ ਗਰਮੀ ਹੋਗੀ ਝੋਨੇ ਦੇ ਟਾਈਮ ਚ ਜਿਵੇਂ ਜਿਆਦਾ ਕੱਟ ਵਗੈਰਾ ਲੱਗਦੇ ਹੈਗੇ ਆ ਠੀਕ ਐ ਬਾਰਿਸ਼ ਦੇ ਮੌਸਮ ਦੇ ਵਿੱਚ ਘੱਟ ਤੂਫਾਨ ਵਗੈਰਾ ਜਦੋਂ ਆ ਜਾਂਦੇ ਹੈਗੇ ਉਦੋਂ ਬਹੁਤ ਲੰਬੇ ਕੱਟ ਹੋ ਜਾਂਦੇ ਨੇ ਤਾਂ ਕਿ ਐਹ ਬਹੁਤ ਜਿਆਦਾ ਦਿੱਕਤ ਆਂਦੀ ਹੈਗੀ ਆ ਹਾਲਾਂਕਿ ਇਨਵਰਟਰਸ ਹੈਗੇ ਨੇ ਘਰੇ ਅੱਜ ਕੱਲ ਸਭ ਦੇ ਬਟ ਕੀ ਐ ਫਿਰ ਵੀ ਮਤਲਬ ਬਹੁਤ ਜਿਆਦਾ ਦਿੱਕਤ ਪਰੇਸ਼ਾਨੀ ਆਉਂਦੀ ਹੈ ਕਿਉਂਕਿ ਅੱਜ ਕੱਲ ਕੀ ਆ ਬਹੁਤ ਬਿਜਲੀ ਤੇ ਆਪਾਂ ਨਿਰਭਰ ਹੋ ਚੁੱਕੇ ਹੈਗੇ ਆ ਸਾਰੇ ਅਸੀਂ ਠੀਕ ਐ ਅਗਰ ਨਾ ਜ਼ਿਆਦਾ ਲੰਬਾ ਕੱਟ ਹੋ ਜਾਂਦਾ ਤਾਂ ਇੰਵਰਟਰਸ ਵੀ ਡਾਊਨ ਹੋ ਜਾਂਦੇ ਨੇ ਠੀਕ ਐ ਪਹਿਲਾਂ ਦੇ ਟਾਈਮ 'ਚ ਅਗਰ ਬਿਜਲੀ ਚਲੀ ਜਾਂਦੀ ਸੀ ਤਾਂ ਕਿ ਇਹ ਸਾਰਿਆਂ ਨੇ ਇਕੱਠੇ ਵੇੜੇ ਦੇ ਵਿੱਚ ਬਹਿ ਕੇ ਗੱਲਾਂ ਮਾਰਨ ਲੱਗ ਜਾਂਦੇ ਸੀਗੇ ਤਾਂ ਉਹ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਸੀ ਕਦੋਂ ਟਾਈਮ ਟੱਪ ਜਾਂਦਾ ਸੀ ਹੁਣ ਕੀ ਹਰੇਕ ਕੋਈ ਬਿਜਲੀ ਦੇ ਡਿਪੈਂਡ ਐ ਮੋਬਾਈਲਸ ਫੋਨ ਸਭ ਕੋਲ ਹੈਗੇ ਆ ਠੀਕ ਐ ਠੀਕ ਐ ਮੋਬਾਈਲ ਫੋਨਸ ਅੱਜ ਕੱਲ ਸਭ ਕੋਲ ਨੇ ਤਾਂ ਉਹ ਆਪਣੇ ਆਪਣੇ ਫੋਨ ਦੇ ਵਿੱਚ ਸਭ ਬਿਜ਼ੀ ਰਹਿੰਦੇ ਨੇ ਤਾਂ ਉਹਦੇ ਨਾਲ ਕੀ ਐ ਡਿਪਰੈਸਡ ਹੋ ਜਾਂਦੀ ਹੈਗੀ ਲਾਈਫ ਜਦੋਂ ਲਾਈਟ ਬਿਜਲੀ ਜਿਆਦਾ ਦੇਰ ਤੱਕ ਚੱਲ ਜਾਂਦੀ ਐ ਕੱਟ ਲੱਗ ਜਾਂਦਾ ਏ ਤਾਂ ਤਾਂ ਇਹ ਮਤਲਬ ਖਰਾਬ ਮੌਸਮ ਕਰਕੇ ਬਿਜਲੀ ਦਾ ਕੱਟ ਲੰਬਾ ਹੋ ਜਾਂਦਾ ਉਹਦੇ ਨਾਲ ਕੀ ਆ ਬਹੁਤ ਜਿਆਦਾ ਦਿੱਕਤ ਪਰੇਸ਼ਾਨੀ ਆਉਂਦੀ ਹੈਗੀ ਆ ਕਿਉਂਕਿ ਅਸੀਂ ਸਾਰੇ ਬਿਜਲੀ ਤੇ ਨਿਰਭਰ ਆ ਤੋ ਪਰੇਸ਼ਾਨੀ ਸਭ ਨੂੰ ਹੁੰਦੀ ਹੈ ਬਹੁਤ ਜਿਆਦਾ ਪਰੇਸ਼ਾਨੀ ਹੁੰਦੀ ਹੈ ਤੇ ਕਿਤੇ ਨਾ ਕਿਤੇ ਸਾਡੀ ਲਾਈਫ ਕੀ ਐ ਬਹੁਤ ਪ੍ਰਭਾਵਿਤ ਹੁੰਦੀ ਹੈਗੀ ਐ ਅਗਰ ਬਿਜਲੀ ਨਾ ਹੋਊਗੀ ਤਾਂ ਸਾਡੀ ਲਾਈਫ ਦੀ ਅਸੀਂ ਇਮੈਜਿਨ ਵੀ ਨਹੀਂ ਕਰ ਸਕਦੇ ਕਿੱਦਾਂ ਦੀ ਲਾਈਫ ਹੋਊਗੀ